ਹਾਂ ਮੈਂ ਪੇਂਟਿੰਗ ਦੇ ਨਾਲ ਨਾਲ ਪੈਨਸਿਲ ਸਕੈਚਿੰਗ ਵੀ ਕਰਦਾ ਹਾਂ ਕਿਉਂਕਿ ਇਹ ਇੱਕ ਤਾਂ ਬਣਾਉਣ ਵਿੱਚ ਬਹੁਤ ਹੀ ਆਸਾਨ ਹੈ ਇਸ ਵਿੱਚ ਰੰਗਾਂ ਦਾ ਇਸਤੇਮਾਲ ਘੱਟ ਕੀਤਾ ਜਾਂਦਾ ਹੈ ਅਤੇ ਇਹ ਇੱਕ ਸਾਫ਼ ਸੁਥਰੇ ਤਰੀਕੇ ਨਾਲ ਬਣਾਈ ਜਾ ਸਕਦੀ ਹੈ ਪੈਨਸਿਲ ਸਕੈਚਿੰਗ ਨਾਲ ਸਮੇਂ ਦੀ ਬਹੁਤ ਹੀ ਘੱਟ ਵਰਤੋਂ ਹੁੰਦੀ ਹੈ ਸਮਾਂ ਬਹੁਤ ਬਚਦਾ ਹੈ ਇਹ ਬਣਾਉਣ ਵਿੱਚ ਵੀ ਸੌਖੀ ਹੁੰਦੀ ਹੈ ਇਸ ਨੂੰ ਬਣਾਉਣ ਲਈ ਜ਼ਿਆਦਾ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ ਪੈਂਦਾ ਇਸ ਲਈ ਇੱਕ ਪੈਨਸਿਲ ਅਤੇ ਕਾਗਜ਼ ਦੀ ਹੀ ਜ਼ਰੂਰਤ ਪੈਂਦੀ ਹੈ ਜੋ ਕਿ ਬਣਾਉਣ ਵਿੱਚ ਵੀ ਬਹੁਤ ਅੱਛੀ ਲੱਗਦੀ ਹੈ ਅਤੇ ਪੇਂਟਿੰਗ ਵਿੱਚ ਇੱਕ ਸਮਾਂ ਬਹੁਤ ਲੱਗਦਾ ਅਤੇ ਇਸ ਵਿੱਚ ਰੰਗਾਂ ਦਾ ਇਸਤੇਮਾਲ ਵੀ ਕਾਫੀ ਕੀਤਾ ਜਾਂਦਾ ਹੈ ਅਤੇ ਗੰਦਗੀ ਦਾ ਵੀ ਡਰ ਜ਼ਿਆਦਾ ਰਹਿੰਦਾ ਹੈ ਪੈਨਸਿਲ ਸਕੈਚਿੰਗ ਵਿੱਚ ਗੰਦਗੀ ਦਾ ਡਰ ਘੱਟ ਹੁੰਦਾ ਹੈ ਅਤੇ ਅਸਾਨੀ ਨਾਲ ਬਣਾਈ ਜਾ ਸਕਦੀ ਹੈ ਇਸ ਵਿੱਚ ਸਮਾਂ ਵੀ ਬਹੁਤ ਘੱਟ ਇਸਤੇਮਾਲ ਹੁੰਦਾ ਹੈ ਅਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਾਂ ਆਪ ਦੀ ਕਲਾਕਾਰੀ ਨੂੰ ਪੇਸ਼ ਕਰ ਸਕਦੇ ਹਾਂ ਇਸ ਲਈ ਇਸ ਨਾਲ ਕਲਾਕਾਰੀ ਵਿੱਚ ਨਿਖਾਰ ਵੀ ਆਉਂਦਾ ਹੈ ਧੰਨਵਾਦ